ਹੈਲੋ ਸਤਿ ਸ਼੍ਰੀ ਅਕਾਲ ਜੀ ਫਲਿੱਪਕਾਰਟ ਤੋਂ ਬੋਲ ਰਹੇ ਹੈ ਜੀ ਮੈਂ ਤੁਹਾਡੇ ਤੋਂ ਨਾ ਇੱਕ ਵੋਸ਼ਿੰਗ ਮਸ਼ੀਨ ਔਡਰ ਕੀਤੀ ਸੀ ਉਹ ਮੈਨੂੰ ਬਹੁਤ ਪਸੰਦ ਆਈ ਔਰ ਉਹ ਕੱਪੜੇ ਬਹੁਤ ਵਧੀਆ ਧੌਂਦੀ ਹੈ ਡਰਾਇਰ ਵੀ ਬਹੁਤ ਅੱਛਾ ਚੱਲਦਾ ਉਹਦਾ ਔਰ ਉਹਦੇ 'ਚ ਕਪੈਸਟੀ ਵੀ ਬਹੁਤ ਹੈ ਕੱਪੜੇ ਕਾਫ਼ੀ ਸਾਰੇ ਇਕੱਠੇ ਧੋ ਹੋ ਜਾਂਦੇ ਹੈ ਔਰ ਜੋ ਦੱਸਣ ਆਇਆ ਸੀ ਉਹਨੇ ਵੀ ਬਹੁਤ ਚੰਗੀ ਤਰ੍ਹਾਂ ਸਮਝਾ ਕੇ ਗਿਆ ਔਰ ਮਸ਼ੀਨ ਬਹੁਤ ਵਧੀਆ ਚੱਲ ਰਹੀ ਹੈ ਮੈਂ ਬਹੁਤ ਖੁਸ਼ ਹਾਂ ਇਸ ਤੇ ਥੈਂਕ ਯੂ